ਬਦਲਦੇ ਮੌਸਮ ਦੇ ਨਾਲ ਅੱਜ ਦੀ ਖੇਤੀ ਅਤੇ ਮੇਰੇ ਖ਼ਾਸ ਕਰ ਮੇਰੇ ਖੇਤਰ ਦੀ ਖੇਤੀ ਦੇ ਉੱਤੇ ਬਹੁਤ ਹੀ ਜ਼ਿਆਦਾ ਅਸਰ ਪੈ ਰਿਹਾ ਹੈ ਕਿਉਂਕਿ ਬਦਲਦੇ ਮੌਸਮ ਦੇ ਨਾਲ ਅੱਜ ਕੱਲ੍ਹ ਬਾਰਿਸ਼ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਗਈ ਹੈ ਉਸ ਦੇ ਨਾਲ ਜਿਹੜਾ ਬਾਰਿਸ਼ ਦੀ ਗਿਣਤੀ ਅ ਬਾਰਿਸ਼ ਨਾਲ ਹੋਣ ਕਾਰਨ ਕਈ ਤਰ੍ਹਾਂ ਦੀਆਂ ਫ਼ਸਲਾਂ ਨੂੰ ਬਿਮਾਰੀਆਂ ਵੀ ਪੈਂਦੀਆਂ ਹਨ ਅਤੇ ਉਸ ਬਿਮਾਰੀਆਂ ਨੂੰ ਨਜਿੱਠਣ ਵਾਸਤੇ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਉਸ ਦੇ ਉੱਪਰ ਸਪਰੇਅ ਕਰਨੀ ਪੈਂਦੀ ਹੈ ਇਹ ਅਸਰ ਸਭ ਤੋਂ ਵੱਡਾ ਅਸਰ ਪੈ ਰਿਹਾ ਹੈ ਅਤੇ ਬਾਰਿਸ਼ ਨਾ ਹੋਣ ਕਾਰਨ ਸੋਕੇ ਜਿਹੀ ਸਥਿਤੀ ਪੈਦਾ ਹੋ ਰਹੀ ਹੈ ਜਮੀਨੀ ਪਾਣੀ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ ਪਰ ਇਸ ਦੇ ਨਾਲ ਨਾਲ ਹੀ ਕਿਉਂਕਿ ਬਾਰਿਸ਼ਾਂ ਦੇ ਘਟਨਾ ਅਤੇ ਇੱਕ ਤਰ੍ਹਾਂ ਮੌਸਮ ਦੀ ਬਦਲਾਵਟ ਦੇ ਵਿੱਚ ਕਾਰਨ ਹੋਣ ਕਾਰਨ ਜਿਹੜੇ ਅੱਜ ਕੱਲ੍ਹ ਨਵੇਂ ਨਵੇਂ ਤਰ੍ਹਾਂ ਦੇ ਅ ਮੌਸਮੀ ਬਦਲਾਵ ਆ ਰਹੇ ਹਨ ਜਿੰਨਾਂ ਦੇ ਵਿੱਚ ਤੂਫਾਨ ਆ ਰਹੇ ਹਨ ਤੂਫਾਨ ਦੇ ਨਾਲ ਖੇਤੀ ਦੇ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ ਗੜੇ ਪੈ ਜਾਂਦੇ ਹਨ ਅਣਸਮ ਅਣਮਿੱਤ ਅਣਮਿੱਥੇ ਸਮੇਂ 'ਤੇ ਗੜੇ ਪੈ ਜਾਂਦੇ ਹਨ ਜਿਸ ਨਾਲ ਫ਼ਸਲ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ ਇਸ ਨਾਲ ਨਜਿੱਠਣ ਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਫ਼ਸਲ ਦੀਆਂ ਕਿਸਮਾਂ ਨੂੰ ਬਦਲਦੇ ਰਹੀਏ ਫ਼ਸਲ ਦੀ ਵਿਭਿੰਨਤਾ ਕਰੀਏ ਜਿਸ ਨਾਲ ਕਿ ਸਾਡੀਆਂ ਜਮੀਨ ਦੀ ਤਾਕਤ ਨੂੰ ਵੀ ਬਰਕਰਾਰ ਰਹੇ ਫ਼ਸਲੀ ਚੱਕਰ ਦੇ ਹੋਣ ਨਾਲ ਅਸਮਾਨ ਦੇ ਵਿੱਚ ਵੀ ਕਈ ਤਰ੍ਹਾਂ ਦੀ ਚੇਂਜਿਸ ਆਉਣਗੇ ਬਦਲਾਉ ਆਉਣਗੇ ਜਿਹਦੇ ਨਾਲ ਕਿ ਬਾਰਿਸ਼ ਦੀ ਗਿਣਤੀ ਅਤੇ ਮਿਆਦ ਫਿਰ ਤੋਂ ਦੁਬਾਰਾ ਤੋਂ ਵਧੇਗੀ